ਕਿਸਾਨ ਜਾਨਵਰਾਂ ਦੀ ਰਹਿੰਦ ਖੂੰਹਦ ਦਾ ਪ੍ਰਬੰਧ ਕਰਦੇ ਨੇ ਕਿ ਕਿਸਾਨਾਂ ਦੇ ਘਰ ਜੋ ਵੀ ਮੱਝਾਂ ਗਾਵਾਂ ਹੁੰਦੀਆਂ ਨੇ ਉਹਨਾਂ ਦਾ ਗੋਹਾ ਹੁੰਦਾ ਜੋ ਉਹ ਗੋਹੇ ਨੂੰ ਇੱਕ ਟੋਆ ਪੁੱਟ ਕੇ ਉਹਦੇ ਵਿੱਚ ਗੋਹਾ ਇਕੱਠਾ ਕੀਤਾ ਜਾਂਦਾ ਅਤੇ ਗੋਹਾ ਇਕੱਠਾ ਕਰਕੇ ਉਸ ਗੋਹੇ ਤੋਂ ਵੱਖ ਵੱਖ ਕੰਮ ਲੈ ਲੈਂਦੇ ਨੇ ਉਹਨਾਂ ਤੋਂ ਉਹ ਪਾਥੀਆਂ ਵੀ ਵਰਤਦੇ ਨੇ ਅਤੇ ਜੋ ਖਾਦ ਬਣਾਉਣ ਦੇ ਕੰਮ ਆਉਂਦਾ ਉਹ ਗੋਹੇ ਨੂੰ ਇੱਕ ਟੋਆ ਨੱਪ ਕੇ ਦੱਬ ਦਿੱਤਾ ਜਾਂਦਾ ਅਤੇ ਉਸ ਨੂੰ ਕੁਝ ਟਾਈਮ ਬਾਅਦ ਦੁਬਾਰਾ ਕੱਢਿਆ ਜਾਂਦਾ ਅਤੇ ਉਹ ਜਦੋਂ ਬਿਲਕੁਲ ਗਲ ਜਾਂਦਾ ਉਹ ਇੱਕ ਖਾਦ ਬਣ ਜਾਂਦੀ ਹੈ ਅਤੇ ਉਹਨਾਂ ਨੂੰ ਵਾਹਣਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਵਰਤਿਆ ਜਾਂਦਾ ਅਤੇ ਉਸ ਗੋਹੇ ਤੋਂ ਕਈ ਕਿਸਾਨ ਬਾਇਓ ਪਲਾਂਟ ਵੀ ਲਗਾ ਲੈਂਦੇ ਨੇ ਅਤੇ ਉਹਨਾਂ ਤੋਂ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ ਬਾਇਓ ਪਲਾਂਟ ਨਾਲ ਅਤੇ ਉਹੀ ਖਾਦ ਨੂੰ ਉਹ ਵਾਹਣਾਂ ਦੇ ਵਿੱਚ ਪਾ ਪਾਉਂਦੇ ਨੇ ਛਿੜਕਾਅ ਕੀਤਾ ਜਾਂਦਾ ਅਤੇ ਉਹਨਾਂ ਨਾਲ ਸਬਜ਼ੀਆਂ ਸਬਜ਼ੀ ਫਸਲ ਜੋ ਕਿ ਬਹੁਤ ਵਧੀਆ ਹੁੰਦੀ ਹੈ ਅਤੇ ਇਹ ਖਾਦ ਸਮੇਂ ਸਮੇਂ ਸਿਰ ਉਹ ਆਪਣੇ ਵਾਹਣਾਂ ਵਿੱਚ ਪਾਉਂਦੇ ਨੇ ਅਤੇ ਆਪਣੇ ਵਾਹਣਾਂ ਨੂੰ ਸਹੀ ਤਰੀਕੇ ਨਾਲ ਪਾਣੀ ਲਗਾ ਕੇ ਉਹ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਬਹੁਤ ਬਹੁਤ ਧੰਨਵਾਦ